ਮੈਂ ਛੋਟੇ ਹੁੰਦੇ ਮੰਮੀ ਪਾਪਾ ਨਾਲ ਸਤਿਸੰਗ ਚ ਜਾਣਾ ਭਜਨ ਕੀਰਤਨ ਦੇ ਵਿੱਚ ਜਾਣਾ ਤੇ ਮੈਨੂੰ ਬੜਾ ਅੱਛਾ ਲੱਗਦਾ ਸੀ ਇਹ ਚੀਜ਼ਾਂ ਵੇਖਣੀਆਂ ਕਿ ਉਹਨਾਂ ਤੇ ਭਜਨ ਕੀਰਤਨ ਸੁਣਨਾ ਤੇ ਮੈਨੂੰ ਬਹੁਤ ਅੱਛਾ ਲੱਗਦਾ ਸੀਗਾ ਇਹ ਚੀਜ਼ਾਂ ਵੇਖ ਕੇ ਦਿਲ ਵਿੱਚ ਕਈ ਵਾਰੀ ਆਉਂਦਾ ਸੀ ਕਿ ਮੈਂ ਵੀ ਇਹ ਚੀਜ਼ਾਂ ਗਾਵਾਂ ਜਾਂ ਸਿੱਖਾਂ ਇਹਨਾਂ ਚੀਜ਼ਾਂ ਦੀ ਰੁਚੀ ਲਵਾਂ ਮੈਂ ਵੀ ਤੇ ਜਦੋਂ ਮੈਂ ਪੰਦਰਾਂ ਸਾਲ ਦੀ ਹੋਈ ਤੇ ਮੈਨੂੰ ਉਦੋਂ ਗਾਣ ਦੀ ਰੁਚੀ ਪੈਦਾ ਹੋਈ ਤੇ ਮੈਂ ਛੋਟੀ ਛੋਟੀ ਕੀਰਤਨਾਂ ਵਿੱਚ ਭਜਨ ਮੰਡਲੀ ਨਾਲ ਜਾਣ ਲੱਗੀ ਉਹਨਾਂ ਨਾਲ ਗਾਣ ਲੱਗੀ ਤੇ ਉਸ ਤੋਂ ਬਾਅਦ ਮੈਨੂੰ ਆਪਣੀ ਮੰਡਲੀ ਬਣਾਈ ਮੈਂ ਜਿੰਨਾ ਕਰਕੇ ਮੈਂ ਛੋਟੇ ਛੋਟੇ ਕੀਰਤਨ ਕਰਨ ਲੱਗੀ ਤੇ ਹੁਣ ਮੈਂ ਕੱਲੇ ਵੀ ਜਾਗਰਨ ਕੀਰਤਨ ਦੇ ਵਿੱਚ ਜਾਂਦੀ ਹਾਂ ਤੇ ਮੈਂ ਕੱਲੇ ਵੀ ਜਾਗਰਣ ਕੱਢਦੀ ਹਾਂ